ਓ ਬਾਈ ਕਿਆ ਹਾਲ ਹੈ ਠੀਕ ਹੈ ਸੁੱਤਾ ਪਿਆ ਉੱਠ ਖੜ੍ਹਿਆ ਕਿਆ ਕਰਦਾ ਉੱਠ ਵੀ ਪਿਆ ਕਰ ਬਾਈ ਟਾਈਮ ਨਾਲ ਬਾਈ ਯਾਰ ਮੈਂ ਕੋਲਜ ਤੋਂ ਮੈਂ ਉਹ ਡਿਗੀਲੋਕਰ ਐਡ ਕਰਨਾ ਸੀਗਾ ਅਤੇ ਮੇਰਾ ਪੁਰਾਣਾ ਨੰਬਰ ਡਿੱਗ ਗਿਆ ਸੀ ਤੈਨੂੰ ਪਤਾ ਹੀ ਹੈ ਉਹ ਨਵਾਂ ਨੰਬਰ ਬਾਈ ਕਿੱਦਾਂ ਐਡ ਹੋਣਾ ਅਤੇ ਮੈਂ ਦੱਸ ਦਿਓ ਪ੍ਰੋਸੈਸ ਕਿਆ ਕਿਆ ਮੈਂ ਨਵਾਂ ਨੰਬਰ ਐਡ ਕਰ ਲਵਾਂ ਫਿਰ ਤੈਨੂੰ ਪਤਾ ਆ ਬਾਅਦ 'ਚ ਅਗਾਹਾਂ ਅਗਾਹਾਂ ਕੰਮ ਲੇਟ ਹੋ ਜਾਣਾ ਫਿਰ ਦੱਸ ਦਿਓ ਮੈਨੂੰ ਕਿਆ ਕਿਆ ਪ੍ਰੋਸੈਸ ਹੈ ਠੀਕ ਹੈ ਬਾਈ ਚਲ ਮੈਂ ਕਰ ਲੈਂਦਾ ਦਿੰਦਾ ਫਿਰ ਤੈਨੂੰ ਦੱਸ ਦਊਂਗਾ ਜਿੱਦਾਂ ਵੀ ਹੋਇਆ ਠੀਕ ਆ ਓਕੇ ਬਾਈ